ਭਾਰਤ ਵਿੱਚ ਅਲੱਗ ਅਲੱਗ ਸਥਾਨਾਂ 'ਤੇ ਇਸ ਵੇਲੇ ਮੌਸਮ ਅਲੱਗ ਅਲੱਗ ਤਰ੍ਹਾਂ ਦਾ ਹੈ ਅਸੀਂ ਪੰਜਾਬ ਦੇ ਵਾਸੀ ਹਾਂ ਇਸ ਕਰਕੇ ਪੰਜਾਬ ਦਾ ਮੌਸਮ ਫਿਲਹਾਲ ਠੰਡਾ ਹੈ ਪਹਿਲੇ ਬਹੁਤ ਠੰਡਾ ਸੀ ਹੁਣ ਥੋੜ੍ਹਾ ਘੱਟ ਠੰਡਾ ਹੈ ਇਸ ਕਰਕੇ ਇਸ ਤਰ੍ਹਾਂ ਹੀ ਲੱ ਭਾਰਤ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਵਿੱਚ ਬੜੀ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ ਜਿਵੇਂ ਕਿ ਚਿਰਾਪੂੰਜੀ 'ਚ ਹਰ ਵੇਲੇ ਬਰਸਾਤ ਹੁੰਦੀ ਰਹਿੰਦੀ ਹੈ ਰਾਜਸਥਾਨ ਦੇ ਵਿੱਚ ਓ ਹਮੇਸ਼ਾ ਗਰਮੀ ਹੀ ਰਹਿੰਦੀ ਹੈ ਅਤੇ ਬੌਂਬੇ ਅਤੇ ਗੋਆ ਵਾਲੀ ਸਾਈਡ ਵਿੱਚ ਜਾਈਏ ਤਾਂ ਉੱਥੇ ਸਮੁੰਦਰੀ ਤੱਟ ਨਾਲ ਨੇੜੇ ਹੋਣ ਕਰਕੇ ਉੱਥੇ ਦਾ ਮੌਸਮ ਜਿਹੜਾ ਹੈ ਕਿ ਰਲਿਆ ਮਿਲਿਆ ਜਿਹਾ ਹੁੰਦਾ ਹੈ ਕਦੀ ਗਰਮ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਹੁੰਦਾ ਹੈ ਇਸ ਤਰ੍ਹਾਂ ਹੀ ਅਲੱਗ ਅਲੱਗ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਮੌਸਮ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਇਹ ਸਭ ਵਾਯੂ ਦੇ ਉੱਤੇ ਜਾਂ ਕਰਕ ਰੇਖਾ ਦੇ ਉੱਤੇ ਸਥਿਤ ਹੋਣ ਕਰਕੇ ਉਹਨਾਂ ਦੇ ਵੱਖਰੇ ਵੱਖਰੇ ਤਰ੍ਹਾਂ ਦਾ ਮੌਸਮ ਵੱਖਰਾ ਵੱਖਰਾ ਤਰ੍ਹਾਂ ਦਾ ਹੋ ਜਾਂਦਾ ਹੈ ਭਾਰਤ ਵਿੱਚ ਵੈਸੇ ਤਾਂ ਚਾਰ ਮੌਸਮ ਹੁੰਦੇ ਨੇ ਪੱਤਝੜ ਬਰਸਾਤ ਗਰਮੀ ਸਰਦੀ ਅਤੇ ਇਹ ਮੌਸਮ ਪੰਜਾਬ ਦੇ ਵਿੱਚ ਚਾਰੇ ਹੀ ਪਾਏ ਜਾਂਦੇ ਹਨ ਅਤੇ ਅਲੱਗ ਅਲੱਗ ਖੇਤਰਾਂ ਵਿੱਚ ਮੌਸਮ ਚਾਰੇ ਤਰ੍ਹਾਂ ਦੇ ਨਹੀਂ ਵੀ ਪਾਏ ਜਾਂਦੇ